ਅੱਜ ਕੱਲ੍ਹ ਦੇ ਲੋਕਾਂ ਦੀ ਇਹ ਸੋਚ ਆ ਕਿ ਸ਼ਹਿਰਾਂ ਦੀ ਜ਼ਿੰਦਗੀ ਜ਼ਿਆਦਾ ਵਧੀਆ ਹੁੰਦੀ ਆ ਬਟ ਨਹੀਂ ਪਿੰਡਾਂ ਦੀ ਜ਼ਿੰਦਗੀ ਜ਼ਿਆਦਾ ਵਧੀਆ ਕਿਉਂਕਿ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਪੋਲਿਊਸ਼ਨ ਬਹੁਤ ਵੱਧ ਚੁੱਕਿਆ ਆ ਜੋ ਕਿ ਆਪਣੀ ਸਿਹਤ ਦੇ ਲਈ ਬਹੁਤ ਹਾਨੀਕਾਰਕ ਆ ਪਿੰਡਾਂ ਦੇ ਵਿੱਚ ਕੁਛ ਹੱਦ ਤੱਕ ਪਲਿਊਸ਼ਨ ਦੀ ਮਾਤਰਾ ਘੱਟ ਆ ਪਿੰਡਾਂ ਦੇ ਵਿੱਚ ਆਪਣੇ ਕੋਲ ਜਗ੍ਹਾ ਖੁੱਲ੍ਹੀ ਹੋਣ ਕਾਰਨ ਅਤੇ ਮਾਹੌਲ ਅਤੇ ਪਿੰਡਾਂ ਦਾ ਇਨਵਾਇਰਮੈਂਟ ਇੰਨਾ ਕੁ ਜ਼ਿਆਦਾ ਵਧੀਆ ਹੁੰਦਾ ਆ ਜੋ ਕਿ ਆਪਣੀ ਸਿਹਤ ਵੀ ਤੰਦਰੁਸਤ ਰਹਿੰਦੀ ਆ ਆਪਾਂ ਪਿੰਡਾਂ ਦੇ ਵਿੱਚ ਸਬਜ਼ੀਆਂ ਤਾਜ਼ੀਆਂ ਸਬਜ਼ੀਆਂ ਫਲ ਉਗਾ ਸਕਦੇ ਹਾਂ ਜਿਨ੍ਹਾਂ ਦੇ ਕਿ ਦਵਾਈਆਂ ਦਾ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਜੋ ਕਿ ਆਪਣੀ ਸਿਹਤ ਦੇ ਲਈ ਵੀ ਵਧੀਆ ਆ ਅਤੇ ਪਿੰਡਾਂ ਦੇ ਵਿੱਚ ਮੈਂ ਆਪਣੇ ਘਰ ਦੀਆਂ ਕੰਧਾਂ ਉੱਚੀਆਂ ਰੱਖਾਂਗੀ ਤਾਂ ਜੋ ਜਿਹੜੇ ਜਾਨਵਰ ਆ ਜੀਵ ਆ ਉਹਨਾਂ ਤੋਂ ਬਚ ਚਕ ਬਚ ਸਕਿਆ ਜਾਵੇ ਅਤੇ ਜਿਹੜੀ ਚੁੱਲ੍ਹੇ ਦੇ ਉੱਪਰ ਆਪਾਂ ਪਿੰਡਾਂ ਦੇ ਵਿੱਚ ਕੰਮ ਕਰਦੇ ਹਾਂ ਉਹ ਵੀ ਵਧੀਆ ਹੁੰਦਾ ਕਿਉਂਕਿ ਸ਼ਹਿਰਾਂ ਦੇ ਵਿੱਚ ਅੱਜ ਕੱਲ੍ਹ ਆਪਾਂ ਗੈਸ ਦੀ ਇਸਤੇਮਾਲ ਕਰਦੇ ਹਾਂ ਜੋ ਕਿ ਖਾਣੇ ਦੇ ਵਿੱਚ ਖਾਣੇ ਦੇ ਲਈ ਜਾਂ ਆਪਣੀ ਸਿਹਤ ਦੇ ਲਈ ਸਹੀ ਨਹੀਂ ਆ ਬਟ ਪਿੰਡਾਂ ਦੇ ਵਿੱਚ ਆਪਾਂ ਦੇਸੀ ਚੁੱਲ੍ਹਿਆਂ 'ਤੇ ਅੱਗ ਦੇ ਉੱਪਰ ਕੰਮ ਕਰਦੇ ਹਾਂ ਆਪਾਂ ਆਪਣੀ ਰੋਟੀ ਅਤੇ ਸਬਜ਼ੀ ਅੱਗ ਦੇ ਉੱਪਰ ਬਣਾਉਂਦੇ ਹਾਂ ਜੋ ਕਿ ਜ਼ਿਆਦਾ ਵਧੀਆ ਆਪਣੀ ਸਿਹਤ ਵੀ ਤੰਦਰੁਸਤ ਰਹਿੰਦੀ ਆ ਇਸ ਲਈ ਮੈਂ ਇਹੀ ਕਹਿਣਾ ਚਾਹੂੰਗੀ ਕਿ ਪਿੰਡਾਂ ਦੀ ਜ਼ਿੰਦਗੀ ਜ਼ਿਆਦਾ ਵਧੀਆ ਆ ਸ਼ਹਿਰਾਂ ਨਾਲੋਂ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਲੋਕ ਆ ਉਹ ਵੀ ਪਿੰਡਾਂ ਦੇ ਵਿੱਚ ਸ਼ਿਫਟ ਹੋ ਜਾਣਗੇ ਕਿਉਂਕਿ ਸ਼ਹਿਰਾਂ ਦਾ ਜਿਹੜਾ ਮਾਹੌਲ ਆ ਉਹ ਇੰਨਾ ਵਧੀਆ ਨਹੀਂ ਰਹਿ ਚੁੱਕਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਮਾੜਾ ਹੋਊਗਾ ਥੈਂਕ ਯੂ